ਹਾਂਜੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਡਾਂਸ ਵਿੱਚ ਆਉਣ ਦੀ ਮੇਰੀ ਜਿਹੜੀ ਰੁਚੀ ਹੈ ਉਹ ਛੇਵੀਂ ਕਲਾਸ ਤੋਂ ਸ਼ੁਰੂ ਹੁੰਦੀ ਹੈ ਜਦੋਂ ਮੈਂ ਪੰਜਾਬੀ ਫਿਲਮਾਂ ਦੇ ਵਿੱਚ ਐਕਟਰਸ ਨੂੰ ਡਾਂਸ ਕਰਦੇ ਹੋਏ ਦੇਖਦਾ ਸੀ ਤਾਂ ਮੇਰਾ ਮਨ ਵੀ ਡਾਂਸ ਕਰਨ ਨੂੰ ਹੀ ਕਰਦਾ ਸੀ ਤਾਂ ਇਸ ਤਰ੍ਹਾਂ ਮੈਂ ਲੁਕ ਲੁਕ ਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਮੈਂ ਛੋਟਾ ਹੁੰਦਾ ਸੀ ਤਾਂ ਵਿਆਹਾਂ ਸ਼ਾਦੀਆਂ ਉੱਤੇ ਵੀ ਭੰਗੜਾ ਪਾਉਂਦਾ ਸੀ ਤਾਂ ਮੈਨੂੰ ਲੋਕ ਪਸੰਦ ਕਰਦੇ ਸੀ ਇਸ ਤਰ੍ਹਾਂ ਮੇਰੇ ਭੰਗੜੇ ਵਿੱਚ ਆਉਣ ਦੀ ਸ਼ੁਰੂਆਤ ਹੋ ਗਈ ਹੌਲੀ ਹੌਲੀ ਮੈਂ ਸਕੂਲ ਦੇ ਫੰਕਸ਼ਨਾਂ ਉੱਤੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਕਾਫ਼ੀ ਇਨਾਮ ਵੀ ਮਿਲੇ ਅਤੇ ਮੈਨੂੰ ਕਾਫ਼ੀ ਪਸ਼ੰਸਾ ਪੱਤਰ ਵੀ ਮਿਲੇ ਭੰਗੜਾ ਮੇਰੀ ਜਿੰਦਗੀ ਦਾ ਇੱਕ ਅਟੁੱਟ ਅੰਗ ਬਣ ਗਿਆ ਹੈ ਭੰਗੜੇ ਨਾਲ ਮੈਂ ਆਪਣਾ ਜਿਹੜਾ ਸਰੀਰ ਆ ਉਹ ਵੀ ਫਿੱਟ ਰੱਖਿਆ ਹੋਇਆ ਹੈ ਮੈਂ ਰੋਜ਼ ਦੋ ਘੰਟੇ ਭੰਗੜਾ ਕਰਦਾ ਹਾਂ ਅਤੇ ਮੈਂ ਆਪਣੇ ਬੱਚਿਆਂ ਨੂੰ ਵੀ ਭੰਗੜਾ ਸਿਖਾਉਂਦਾ ਹਾਂ ਭੰਗੜੇ ਵਿੱਚ ਆਉਣਾ ਮੇਰੇ ਲਈ ਇੱਕ ਬਹੁਤ ਵੱਡੀ ਗੱਲ ਸੀ ਭੰਗੜਾ ਇਹ ਕੋਈ ਆਮ ਬੰਦਾ ਨਹੀਂ ਪਾ ਸਕਦਾ ਭੰਗੜਾ ਇਹ ਕੋਈ ਖ਼ਾਸ ਬੰਦਾ ਹੀ ਪਾ ਸਕਦਾ ਹੈ ਕਿਉਂਕਿ ਇਸਦੇ ਜਿਹੜੇ ਸਟੈਪ ਹੁੰਦੇ ਹਨ ਉਹ ਬਹੁਤ ਹੀ ਸੋਚ ਸਮਝ ਕੇ ਕਰਨੇ ਪੈਂਦੇ ਹਨ ਸਾਡੇ ਪਿੰਡ ਦੇ ਵਿੱਚ ਇੱਕ ਭੰਗੜਾ ਸਿਖਾਊ ਕਲੱਬ ਵੀ ਹੈ ਜਿਸ ਦੇ ਵਿੱਚ ਮੈਂ ਵੀ ਇੱਕ ਮੈਂਬਰ ਹਾਂ ਅਤੇ ਮੈਂ ਵੀ ਅੱਧਾ ਘੰਟਾ ਭੰਗੜਾ ਸਿਖਾਉਣ ਲਈ ਜਾਂਦਾ ਹਾਂ ਅਤੇ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਜਾਣਕਾਰੀ ਦਿੰਦਾ ਹਾਂ ਸਾਡੇ ਪਹਿਰਾਵੇ ਬਾਰੇ ਦੱਸਦਾ ਹਾਂ ਜਿਸ ਨਾਲ ਸਾਡਾ ਭੰਗੜਾ ਸਾਡਾ ਨਾਚ ਅੱਜ ਸਾਡਾ ਸਭਿਆਚਾਰ ਅੱਗੇ ਵੱਧਦਾ ਹੈ ਅਤੇ ਵਿਕਾਸ ਕਰਦਾ ਹੈ ਮੈਨੂੰ ਯਾਦ ਹੈ ਜਦੋਂ ਮੈਂ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ ਤਾਂ ਮੈਂ ਸਭ ਤੋਂ ਪਹਿਲਾਂ ਪੰਜਾਬੀ ਫਿਲਮਾਂ ਦੇ ਨਾਇਕ ਹਰਭਜਨ ਸਿੰਘ ਨੂੰ ਦੇਖਿਆ ਸੀ ਅਤੇ ਉਹ ਭੰਗੜੇ ਪਾ ਰਹੇ ਸਨ ਅਤੇ ਸਰਬਜੀਤ ਚੀਮਾ ਜੀ ਸਾਡੇ ਸਿੰਗਰ ਵੀ ਹਨ ਅਤੇ ਐਕਟਰ ਵੀ ਹਨ ਉਹ ਵੀ ਭੰਗੜੇ ਪਾਉਂਦੇ ਸੀ ਫਿਲਮਾਂ ਦੇ ਵਿੱਚ ਤਾਂ ਮੈਂ ਉਹਨਾਂ ਨੂੰ ਦੇਖ ਦੇਖ ਕੇ ਸਿੱਖਿਆ ਫਿਰ ਇਹ ਭੰਗੜਾ ਸਾਡੇ ਹਿੰਦੀ ਗਾਣਿਆਂ ਵਿੱਚ ਵੀ ਆਉਣ ਲੱਗ ਪਿਆ ਅਤੇ ਸਾਡੇ ਬਹੁਤ ਸਾਰੇ ਸੰਗੀਤਕ ਅਕੈਡਮੀਆਂ ਖੁੱਲ੍ਹੀਆਂ ਹੋਈਆਂ ਹਨ ਜੋ ਕਿ ਭੰਗੜਾ ਸਿਖਾਉਂਦੀਆਂ ਹਨ ਧੰਨਵਾਦ